ਮੇਰਾ ਨਾਮ ਨੈਨਸੀ ਹੈ ਮੈਂ ਬਚਪਨ ਵਿੱਚ ਕਰੀ ਯਾਤਰਾ ਬਾਰੇ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਮੈਂ ਬਚਪਨ ਵਿੱਚ ਮਾਤਾ ਨੈਣਾ ਦੇਵੀ ਘੁੰਮਣ ਗਈ ਸੀ ਮੈਂ ਜਦੋਂ ਛੋਟੀ ਸੀ ਤਾਂ ਮੈਂ ਪਹਿਲੀ ਵਾਰ ਮਾਤਾ ਨੈਣਾ ਦੇਵੀ ਦੇ ਦਰਸ਼ਨ ਕੀਤੇ ਸੀ ਮਾਤਾ ਨੈਣਾ ਦੇਵੀ ਦੇ ਘੁੰਮਣ ਲਈ ਬਹੁਤ ਕੁਝ ਸੀ ਜਿਵੇਂ ਕਿ ਸਮੁੰਦਰਾਂ ਦੀ ਸੈਰ 'ਤੇ ਉਸ ਵਿੱਚ ਕਿਸ਼ਤੀਆਂ ਵੀ ਸੀ ਫਿਰ ਮੱ ਫਿਰ ਮਾਤਾ ਨੈਣਾ ਦੇਵੀ ਦੇ ਬਹੁਤ ਸਾਰੀਆਂ ਘੁੰਮਣ ਵਾਲੀਆਂ ਥਾਵਾਂ ਸੀ ਉਹ ਦਿਨ ਮੈਂ ਕਦੇ ਨਹੀਂ ਭੁੱਲ ਸਕਦੀ ਫਿਰ ਮੱਥਾ ਟੇਕ ਕੇ ਅਸੀਂ ਬਾਬਾ ਬਾਲਕ ਨਾਥ ਜੀ ਦੇ ਗਏ ਉੱਥੇ ਵੀ ਘੁੰਮਣ ਵਾਲੀਆਂ ਬਹੁਤ ਥਾਵਾਂ ਹਨ ਉੱਥੇ ਬਾਬਾ ਬਾਲਕ ਨਾਥ ਜੀ ਦੀ ਮਾਤਾ ਰਤਨੋ ਦੇ ਦਰਸ਼ਨ ਕੀਤੇ ਸੀ ਕੁਝ ਝਾ ਝਾੜੀ ਜਿੱਥੇ ਯੋਗੀ ਸਿੱਧ ਬਾਬਾ ਬਾਲਕ ਨਾਥ ਜੀ ਨੇ ਤਪੱਸਿਆ ਕੀਤੀ ਹੈ ਫਿਰ ਅਸੀਂ ਮੱਥਾ ਟੇਕਣ ਲਈ ਗੁਫਾ 'ਤੇ ਗਏ ਥੱਲੇ ਬਾਬਾ ਬਾਲਕ ਨਾਥ ਜੀ ਦਾ ਧੂਣਾ ਹੈ ਮੈਂ ਉਹ ਸਫਰ ਕਦੇ ਨਹੀਂ ਭੁੱਲ ਸਕਦੀ ਅਤੇ ਮੈਂ ਉਹ ਸਾਂਝੀ ਯਾਦ ਕਦੇ ਨਹੀਂ ਭੁੱਲ ਸਕਦੀ